ਪੰਜਾਬ ਸਰਕਾਰ ਨੇ ਆਪਣੇ ਵਸਨੀਕਾਂ ਵਿੱਚ ਉੱਦਮਤਾ ਅਤੇ ਹੁਨਰ ਵਿਕਾਸ ਨੂੰ ਉਤਸਾਹਿਤ ਕਰਨ ਲਈ ਕਈ ਨੀਤੀਆਂ ਅਤੇ ਪਹਿਲਕਦਮੀਆਂ ਲਾਗੂ ਕੀਤੀਆਂ ਹਨ ਮੁੱਖ ਪ੍ਰੋਗਰਾਮਾਂ ਵਿੱਚ ਸ਼ਾਮਿਲ ਹਨ ਈ ਰੋਜ਼ਗਾਰ ਪ੍ਰੋਗਰਾਮ ਜੋ ਕਿ ਦੋ ਹਜ਼ਾਰ ਸਤਾਰ੍ਹਾਂ ਵਿੱਚ ਸ਼ੁਰੂ ਕੀਤਾ ਗਿਆ ਇਸ ਪਹਿਲ ਦਾ ਉਦੇਸ਼ ਨੌਜਵਾਨ ਗ੍ਰੈਜੂਏਟਾਂ ਨੂੰ ਡਿਜੀਟਲ ਹੁਨਰ ਅਤੇ ਫਰੀਲਾਂਸਿੰਗ ਸਮੱਰਥਾਵਾਂ ਨਾਲ ਸ਼ਕਤੀਸ਼ਾਲੀ ਬਣਾਉਣਾ ਹੈ ਇਹ ਪ੍ਰੋਗਰਾਮ ਤਕਨੀਕੀ ਸਮਗਰੀ ਮਾਰਕੀਟਿੰਗ ਅਤੇ ਇਸ਼ਤਿਹਾਰਬਾਜ਼ੀ ਰਚਨਾਤਮਕ ਡਿਜ਼ਾਈਨਿੰਗ ਈ ਕਮਰਸ ਮੋਬਾਇਲ ਐਪ ਵਿਕਾਸ ਡਿਜੀਟਲ ਅਤੇ ਸੋਸ਼ਲ ਮੀਡੀਆ ਮਾਰਕੀਟਿੰਗ ਅਤੇ ਯੂਆਈ ਯੂਐਕਸ ਡਿਜਾਇਨ ਵਰਗੇ ਖੇਤਰਾਂ ਵਿੱਚ ਕੋਰਸ ਪੇਸ਼ ਕਰਦਾ ਹੈ ਇਹਨਾਂ ਹੁਨਰਾਂ ਨੂੰ ਪ੍ਰਦਾਨ ਕਰਕੇ ਪ੍ਰੋਗਰਾਮ ਭਾਗੀਦਾਰਾਂ ਨੂੰ ਆਨਲਾਈਨ ਕਮਾਈ ਕਰਨ ਦੇ ਯੋਗ ਬਣਾਉਂਦਾ ਹੈ ਡਿਜੀਟਲ ਆਰਥਿਕਤਾ ਵਿੱਚ ਉੱਦਮਤਾ ਨੂੰ ਉਤਸਾਹ ਕਰਦਾ ਹੈ ਗੈਰ ਮੁਨਾਫਾ ਸੰਗਠਨ ਸਾਂਝੀ ਸਿੱਖਿਆ ਦੁਆਰਾ ਚਲਾਈ ਜਾ ਰਹੀ ਪੰਜਾਬ ਯੂਥ ਲੀਡਰਸ਼ਿਪ ਪ੍ਰੋਗਰਾਮ ਦੋ ਸਾਲ ਦੀ ਫੈਲੋਸ਼ਿਪ ਹੈ ਜੋ ਨੌਜਵਾਨ ਨੇਤਾਵਾਂ ਨੂੰ ਸਿਖਲਾਈ ਦਿੰਦੀ ਹੈ ਇਹ ਫੈਲੋ ਕਲਾਸਰੂਮ ਅਧਿਆਪਨ ਨੂੰ ਵਧਾਉਣ ਲਈ ਅਧਿਆਪਕਾਂ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਸਥਾਨਕ ਸ਼ਾਸਨ ਨੂੰ ਬਿਹਤਰ ਬਣਾਉਣ ਲਈ ਨੌਕਰਸ਼ਾਹਾਂ ਨਾਲ ਸਹਿਯੋਗ ਕਰਦੇ ਹਨ ਭਾਰਤ ਸਰਕਾਰ ਦੁਆਰਾ ਦੋ ਹਜ਼ਾਰ ਵੀਹ ਵਿੱਚ ਸ਼ੁਰੂ ਕੀਤੀ ਗਈ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਸਟਾਰਟ ਐਪਸ ਐਗਰੀਟੈਕ ਖਿਡਾਰੀਆਂ ਅਤੇ ਕਿਸਾਨ ਸਮੂਹਾਂ ਨੂੰ ਬੁਨਿਆਦੀ ਢਾਂਚੇ ਅਤੇ ਲੋਜਿਸਟਿਕ ਸਹੂਲਤਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਇਸ ਫੰਡ ਤਹਿਤ ਪੰਜਾਬ ਨੂੰ ਸੰਤਾਲੀ ਸੌ ਤੇਰ੍ਹਾਂ ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਬਾਗਬਾਨੀ ਵਿਭਾਗ ਇਸ ਨੂੰ ਲਾਗੂ ਕਰਨ ਲਈ ਰਾਜ ਨੋਡਲ ਏਜੰਸੀ ਵਜੋਂ ਕੰਮ ਕਰ ਰਿਹਾ ਹੈ ਪੰਜਾਬ ਸੇਵਾ ਦਾ ਅਧਿਕਾਰ ਐਕਟ ਵੱਖ ਵੱਖ ਸੇਵਾਵਾਂ ਨੂੰ ਕਵਰ ਕਰਦਾ ਹੈ ਜਿਸ ਦਾ ਉਦੇਸ਼ ਕਾਰੋਬਾਰੀ ਕਾਰਜਾਂ ਨੂੰ ਸੁਵਿਧਾਜਨਕ ਬਣਾਉਣਾ ਅਤੇ ਉੱਦਮਤਾ ਨੂੰ ਉਤਸਾਹਿਤ ਕਰਨਾ ਹੈ ਇਹਨਾਂ ਪਹਿਲਕਦਮੀਆਂ ਰਾਹੀਂ ਪੰਜਾਬ ਸਰਕਾਰ ਦਾ ਉਦੇਸ਼ ਉੱਦਮਤਾ ਅਤੇ ਹੁਨਰ ਵਿਕਾਸ ਲਈ ਅਨੁਕੂਲ ਵਾਤਾਵਰਨ ਸਿਰਜਣਾ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਅਤੇ ਆਪਣੇ ਨਾਗਰਿਕਾਂ ਵਿੱਚ ਆਤਮਨਿਰਭਰਤਾ ਨੂੰ ਹੁਲਾਰਾ ਦੇਣਾ ਹੈ